ਮੇਰੀ ਸਮੱਸਿਆ ਇਹ ਹੈ ਕਿ ਮੈਂ ਆਪਣੇ ਡੇਟਾ ਅਤੇ ਮੋਬਾਇਲ ਦੀ ਜਾਂਚ ਕਰਵਾਉਣਾ ਚਾਹੁੰਦੀ ਹਾਂ ਗੱਲ ਇਹ ਹੈ ਕਿ ਮੈਂ ਆਪਣੇ ਘਰ ਤੋਂ ਬਹੁਤ ਦੂਰ ਰਹਿੰਦੀ ਹਾਂ ਅਤੇ ਮੈਨੂੰ ਰੋਜ਼ ਆਪਣੇ ਕਲਾਇੰਟਸ ਦੇ ਨਾਲ ਵੀਡੀਓ ਮੀਟਿੰਗਸ ਕਰਨੀਆਂ ਪੈਂਦੀਆਂ ਹਨ ਜੋ ਕਿ ਦੂਸਰੇ ਸ਼ਹਿਰਾਂ ਵਿੱਚ ਦੂਸਰੇ ਸਟੇਟ ਵਿੱਚ ਅਤੇ ਦੂਸਰੀ ਕੰਟਰੀਆਂ ਵਿੱਚ ਵੀ ਕਈ ਵਾਰ ਹੁੰਦੀਆਂ ਹਨ ਇਹਨਾਂ ਵੀਡੀਓ ਕਾਲ ਦੇ ਚੱਲਦੇ ਮੈਨੂੰ ਆਪਣੇ ਡੇਟਾ ਅਤੇ ਬਾਕੀ ਮੋਬਾਈਲ ਦੀ ਸੈਟਿੰਗਸ